ਅਸੀਂ ਹਾਲ ਵਿੱਚ ਬਸੰਤ ਪੰਚਮੀ ਮਨਾਈ ਹੈ ਇਸ ਦਿਨ ਮੇਲਾ ਲੱਗਦਾ ਹੈ ਲੋਕ ਪਤੰਗ ਉਡਾਉਂਦੇ ਹਨ ਅਤੇ ਪੀਲੇ ਕੱਪੜੇ ਪਾਉਂਦੇ ਹਨ ਮੁਸਲਮਾਨਾਂ ਵਿੱਚ ਰਮਜਾਨ ਮਨਾਇਆ ਜਾਂਦਾ ਹੈ ਇਸ ਦਿਨ ਮੁਸਲਮਾਨ ਰੋਜੇ ਰੱਖਦੇ ਹਨ ਅਤੇ ਨਮਾਜ਼ ਪੜ੍ਹਦੇ ਹਨ ਸ਼ਾਮ ਨੂੰ ਛੇ ਵਜੇ ਤੋਂ ਬਾਅਦ ਰਮ ਰੋਜਾ ਖੋਲ੍ਹ ਕੇ ਰੋਟੀ ਖਾਂਦੇ ਹਨ ਇਸ ਦਿਨ ਮੁਸਲਮਾਨ ਸਾਰੇ ਹੀ ਰੋਜੇ ਰੱਖਦੇ ਹਨ ਅਤੇ ਦਾਨ ਪੁੰਨ ਵੀ ਬਹੁਤ ਕਰਦੇ ਹਨ ਕ੍ਰਿਸਮਿਸ ਵੀ ਮਨਾਇਆ ਜਾਂਦਾ ਹੈ ਇਸ ਦਿਨ ਲੋਕ ਮੋਮਬਤੀਆਂ ਜਲਾ ਕੇ ਪ੍ਰਾਰਥਨਾ ਕਰਦੇ ਹਨ ਨਵਰਾਤਰੇ ਵਾਲੇ ਦਿਨ ਘਰਾਂ ਵਿੱਚ ਸਾਫ ਸਫਾਈ ਕੀਤੀ ਜਾਂਦੀ ਹੈ ਛੋਟੀਆਂ ਬੱਚੀਆਂ ਦੇ ਪੈਰ ਧੋ ਕੇ ਉਹਨਾਂ ਦਾ ਘਰਾਂ ਵਿੱਚ ਸਵਾਗਤ ਕੀਤਾ ਜਾਂਦਾ ਹੈ ਅਤੇ ਇਸ ਦਿਨ ਦਾਨ ਪੁੰਨ ਵੀ ਕੀਤਾ ਜਾਂਦਾ ਹੈ ਛੱਬੀ ਜਨਵਰੀ ਵਾਲੇ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਪਿੰਡ ਪਹੂਵਿੰਡ ਸਾਹਿਬ ਮੇਲਾ ਮਨਾਇਆ ਜਾਂਦਾ ਹੈ ਸੰਗਤਾਂ ਦੂਰ ਦੂਰ ਤੋਂ ਆ ਕੇ ਦਰਸ਼ਨ ਕਰਦੀਆਂ ਹਨ ਅਤੇ ਗੁਰੂ ਜੀ ਦੇ ਖੁਸ਼ੀ ਨੂੰ ਜ਼ਾਹਿਰ ਕਰਦੇ ਹਨ